ਪੰਜਾਬ ਦੇ ਜਿਹੜੇ ਲੋਕ ਨੇ ਉਹ ਧਰਮ ਦੇ ਅਧਾਰ 'ਤੇ ਜਿਹੜੀ ਸਿਹਤ ਹੈ ਜਾਂ ਤੰਦਰੁਸਤੀ ਹੈ ਉਹਦੇ ਮੁੱਦੇ ਨੂੰ ਅਲੱਗ ਅਲੱਗ ਤਰ੍ਹਾਂ ਜਿਹੜੇ ਹੱਲ ਕਰਦੇ ਨੇ ਸਭ ਦਾ ਆਪਣਾ ਆਪਣਾ ਢੰਗ ਹੈ ਤੰਦਰੁਸਤੀ ਦੇ ਮੁੱਦੇ ਨੂੰ ਹੱਲ ਕਰਨ ਦਾ ਕੁਛ ਲੋਕ ਨੇ ਉਹ ਬਹੁਤ ਜ਼ਿਆਦਾ ਆਸਤਕ ਹੁੰਦੇ ਨੇ ਪਰਮਾਤਮਾ ਦੇ ਵਿੱਚ ਉਹਨਾਂ ਦਾ ਬਹੁਤ ਵਿਸ਼ਵਾਸ ਹੁੰਦਾ ਹੈ ਔਰ ਉਹਨਾਂ ਦਾ ਇਹ ਮੰਨਣਾ ਹੁੰਦਾ ਹੈ ਕੇ ਜਿਹੜੀ ਅਰਦਾਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਕੀਤੀ ਜਾਂਦੀ ਹੈ ਨਿਮਰ ਹੋ ਕੇ ਉਹਦਾ ਫਲ ਜਿਹੜਾ ਹੈ ਦੇਰ ਸਵੇਰ ਜ਼ਰੂਰ ਮਿਲਦਾ ਹੈ ਔਰ ਉਹ ਉਸ ਮੁੱਦੇ ਨੂੰ ਹੱਲ ਕਰਨ ਲਈ ਆਪਣੇ ਹਿਸਾਬ ਦੇ ਨਾਲ ਅਗਰ ਕੋਈ ਸਿੱਖ ਹੈ ਤਾਂ ਗੁਰਦੁਆਰਿਆਂ ਦੇ ਵਿੱਚ ਅਗਰ ਕੋਈ ਹਿੰਦੂ ਹੈ ਤਾਂ ਉਹ ਮੰਦਰਾਂ ਦੇ ਵਿੱਚ ਅਗਰ ਕੋਈ ਮੁਸਲਮਾਨ ਹੈ ਤਾਂ ਉਹ ਮਸਜਿਦਾਂ ਦੇ ਵਿੱਚ ਮੱਥੇ ਟੇਕ ਕੇ ਔਰ ਪਰਮਾਤਮਾ ਅੱਗੇ ਅਰਦਾਸਾਂ ਕਰਦੇ ਨੇ ਤੰਦਰੁਸਤੀ ਦੀਆਂ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਕੁਛ ਲੋਕ ਇਹੋ ਜਿਹੇ ਨੇ ਜੋ ਮੈਡੀਟੇਸ਼ਨ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਮੈਡੀਟੇਸ਼ਨ ਕਰਕੇ ਸਪਿਰਚੂਅਲ ਉਹ ਬਣ ਸਕਦੇ ਨੇ ਔਰ ਆਪਣੀਆਂ ਜਿਹੜੇ ਤੰਦਰੁਸਤੀ ਦੇ ਮੁੱਦੇ ਨੇ ਉਹਨਾਂ ਨੂੰ ਹੱਲ ਕਰ ਸਕਦੇ ਨੇ ਔਰ ਮੈਡੀਟੇਸ਼ਨ ਜਿਹੜੀ ਹੈ ਉਹ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਉਹਨੂੰ ਦੂਰ ਭਜਾਉਂਦੀ ਹੈ ਉਸ ਤੋਂ ਇਲਾਵਾ ਕੁਝ ਲੋਕ ਇਹੋ ਜਿਹੇ ਨੇ ਜਿਹੜੇ ਡੋਕਟਰੀ ਜਿਹੜੀਆਂ ਦੇਖਭਾਲ ਹੈ ਉਹਦੇ ਵਿੱਚ ਵਿਸ਼ਵਾਸ ਰੱਖਦੇ ਨੇ ਉਹਨਾਂ ਦਾ ਵਿਸ਼ਵਾਸ ਹੈ ਕਿ ਅਗਰ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਹੈ ਜਾਂ ਉਹ ਤੰਦਰੁਸਤ ਰਹਿਣਾ ਚਾਹੁੰਦੇ ਨੇ ਤਾਂ ਸਿਰਫ਼ ਅਤੇ ਸਿਰਫ਼ ਉਹਦਾ ਜਿਹੜਾ ਹੱਲ ਹੈ ਉਹ ਇੱਕ ਪੜ੍ਹਿਆ ਲਿਖਿਆ ਜਿਹੜਾ ਡਾਕਟਰ ਹੈ ਜਿਹਨੂੰ ਤਜਰਬਾ ਹੈ ਸਿਹਤ ਸਬੰਧੀ ਉਹ ਹੀ ਕਰ ਸਕਦਾ ਹੈ ਤਾਂ ਉਹ ਇਹਨਾਂ ਸਾਰੇ ਚੱਕਰਾਂ 'ਚ ਨਹੀਂ ਪੈਂਦੇ ਉਹ ਸਿਰਫ਼ ਅਤੇ ਸਿਰਫ਼ ਡੋਕਟਰ ਕੋਲ ਜਾ ਕੇ ਦਵਾਈਆਂ ਲੈ ਕੇ ਆਪਣਾ ਜਿਹੜਾ ਇਲਾਜ ਹੈ ਉਹ ਕਰਵਾਉਂਦੇ ਨੇ ਬਹੁਤ ਸਾਰੇ ਲੋਕ ਪੰਜਾਬ ਦੇ ਵਿੱਚ ਇਹੋ ਜਿਹੇ ਨੇ ਜਿਹੜੇ ਭਾਈਚਾਰਕ ਸੇਵਾ ਕਰਦੇ ਨੇ ਭਾਈਚਾਰਕ ਸੇਵਾ ਮਤਲਬ ਕਿਸੇ ਕੋਲ ਹੱਥ ਦਾ ਅਗਰ ਕੋਈ ਗੁਣ ਹੈ ਤਾਂ ਉਹ ਉਸ ਗੁਣ ਦੇ ਆਧਾਰ ਦੇ ਉੱਪਰ ਦੂਸਰੇ ਦਾ ਜਿਹੜਾ ਭਲਾ ਕਰਦਾ ਹੈ ਬਹੁਤ ਸਾਰੇ ਲੋਕ ਨੇ ਇੱਥੇ ਜਿਹੜੇ ਪੜ੍ਹੇ ਲਿਖੇ ਨੇ ਔਰ ਚਾਹੇ ਉਹ ਡੋਕਟਰ ਨੇ ਜਾਂ ਉਹਨਾਂ ਦੇ ਹੱਥ ਵਿੱਚ ਕੋਈ ਗੁਰ ਹੈ ਕਿਸੇ ਨੂੰ ਠੀਕ ਕਰਨ ਦਾ ਤਾਂ ਉਹ ਇਹ ਸਿਰਫ਼ ਸੇਵਾਵਾਂ ਹੀ ਨਿਭਾਉਂਦੇ ਨੇ ਉਹ ਇਹਦੇ ਬਦਲੇ ਦੇ ਵਿੱਚ ਕੋਈ ਪੈਸਾ ਧੇਲਾ ਜਿਹੜਾ ਦੂਸਰੇ ਪਰਸਨ ਦੇ ਕੋਲੋਂ ਨਹੀਂ ਲੈਂਦੇ